ਲੰਡਨ ਯੂ ਕੇ ਵਿੱਚ ਪੈਰਿਸ ਫਰਾਂਸ ਵਿੱਚ ਨਿਊਯਾਰਕ ਯੂ ਐੱਸ ਏ ਵਿੱਚ ਸੈਨ ਫਰਾਂਸਿਸਕੋ ਯੂ ਐੱਸ ਏ ਵਿੱਚ ਅਤੇ ਬਾਰਸੇਲੋਨਾ ਸਪੇਨ ਵਿੱਚ